ਆਲੇ ਖੇਤਰ ਵਿੱਚ ਰਹਿੰਦੀ ਹਾਂ ਪਟਿਆਲੇ ਦੇ ਵਿੱਚ ਜ਼ਿਆਦਾ ਮਲਵਈ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਵਿੱਚ ਬਹੁਤ ਸਾਰੀਆਂ ਖੇਤਰੀ ਉਪ ਭਾਸ਼ਾਵਾਂ ਵੀ ਹਨ ਜਿਵੇਂ ਕਿ ਅ ਮਾਜੀ ਅ ਮਾਝੀ ਮਲਵਈ ਅਤੇ ਪੁਆਧੀ ਦੁਆਬੀ ਹਨ ਇਹਦੇ ਵਿੱਚ ਜਿਵੇਂ ਕਿ ਮਾਝੀ ਹੈ ਉਹ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਵਿੱਚ ਬੋਲੀ ਜਾਂਦੀ ਹੈ ਜਿਹੜੀ ਦੁਆਬੀ ਹੈ ਉਹ ਜਲੰਧਰ ਅਤੇ ਕਪੂਰਥਲੇ ਵਿਚ ਬੋਲੀ ਜਾਂਦੀ ਹੈ ਅਤੇ ਬਾਕੀ ਜਿਵੇਂ ਕਿ ਸਤਲੁਜ ਦਰਿਆ ਤੋਂ ਨੀਚੇ ਜ਼ਿਆਦਾ ਮਲਵਈ ਬੋਲੀ ਜਾਂਦੀ ਹੈ ਜਿਹੜੀ ਪੁਆਧੀ ਹੈ ਉਹ ਰਾਜਪੁਰੇ ਅਤੇ ਪਟਿਆਲੇ ਦੇ ਲੱਗਦੇ ਸ਼ਹਿਰਾਂ ਵਿੱਚ ਹੀ ਜ਼ਿਆਦਾ ਬੋਲੀ ਜਾਂਦੀ ਹੈ ਥੈਂਕ ਯੂ